ਅਸੀਂ ਖਾਣਾ ਬਣਾਉਣ ਦੀਆਂ ਚੀਜ਼ਾਂ ਘਰ ਵਿੱਚ ਹੀ ਤਿਆਰ ਕਰਦੇ ਹਾਂ ਜਿਵੇਂ ਕਿ ਸਬਜ਼ੀਆਂ ਲਿਆ ਕੇ ਬਾਜ਼ਾਰੋਂ ਉਹਨਾਂ ਨੂੰ ਧੋ ਕੇ ਕੱਟ ਕੇ ਸਾਫ਼ ਕਰਕੇ ਰੱਖ ਲਈ ਦੀਆਂ ਨੇ ਜਿਸ ਤਰ੍ਹਾਂ ਦਾਲ ਬਣਾਉਣੀ ਹੈ ਉਹਨੂੰ ਵੀ ਸਾਫ਼ ਕਰਕੇ ਰੱਖ ਲਈ ਦੀ ਹੈ ਜਿਸ ਤਰ੍ਹਾਂ ਚਾਵਲ ਬਣਾਉਣੇ ਹੋਣ ਉਹਨਾਂ ਨੂੰ ਵੀ ਸਾਫ਼ ਕਰਕੇ ਰੱਖ ਲਈ ਦੇ ਨੇ ਇਸ ਤਰ੍ਹਾਂ ਅਸੀਂ ਸਾਰੀਆਂ ਚੀਜ਼ਾਂ ਖਾਣਾ ਬਣਾਉਣ ਵਾਲੀਆਂ ਵਸਤਾਂ ਸਾਫ਼ ਕਰਕੇ ਰੱਖ ਕੇ ਫਿਰ ਅਸੀਂ ਬਣਾਉਂਦੇ ਹਾਂ ਜਿਸ ਤਰ੍ਹਾਂ ਸਬਜ਼ੀਆਂ ਦੇ ਵਿੱਚ ਮਸਾਲੇ ਪੈਂਦੇ ਨੇ ਉਹਨਾਂ ਨੂੰ ਵੀ ਅਸੀਂ ਬਾਜ਼ਾਰ ਤੋਂ ਸਾਬਤ ਮਸਾਲੇ ਲਿਆ ਕੇ ਫਿਰ ਉਹਨਾਂ ਨੂੰ ਘਰ ਵਿੱਚ ਪੀਸਦੇ ਹਾਂ ਇਸ ਤਰ੍ਹਾਂ ਕਿਉਂਕਿ ਸਾਨੂੰ ਪੀਸੇ ਹੋਏ ਮਸਾਲੇ ਬਾਜ਼ਾਰ ਵਿੱਚੋਂ ਸਹੀ ਨਹੀਂ ਮਿਲਦੇ ਖਾਣਾ ਟੇਸਟੀ ਨਹੀਂ ਬਣਦਾ ਇਸ ਲਈ ਅਸੀਂ ਘਰ ਪੀਸ ਕੇ ਮਸਾਲੇ ਤਿਆਰ ਕਰਦੇ ਹਾਂ ਉਸ ਕਾ ਇਸ ਤਰ੍ਹਾਂ ਸਾਡਾ ਖਾਣਾ ਵੀ ਟੇਸਟੀ ਬਣਦਾ ਹੈ ਅਤੇ ਬੱ ਸਾਡੇ ਪਰਿਵਾਰ ਨੂੰ ਪਸੰਦ ਵੀ ਆਉਂਦਾ ਹੈ